ਸਤਿ ਸ਼੍ਰੀ ਅਕਾਲ ਮੈਂ ਕਮਲ ਗੱਲ ਕਰ ਰਹੀ ਹਾਂ ਮੈਂ ਇੱਕ ਮਹੀਨਾ ਪਹਿਲਾਂ ਤੁਹਾਡੀ ਵੈੱਬਸਾਈਟ ਤੋਂ ਕੁਛ ਮੇਕਅਪ ਦੇ ਪ੍ਰੋਡਕਟਸ ਔਡਰ ਕੀਤੇ ਸਨ ਜੋ ਕਿ ਮੈਨੂੰ ਟਾਈਮ ਨਾਲ ਨਹੀਂ ਮਿਲੇ ਤੁਸੀਂ ਪੰਦਰਾਂ ਦਿਨ ਦਾ ਟਾਈਮ ਕਿਹਾ ਸੀ ਪਰ ਮੈਨੂੰ ਮਹੀਨੇ ਵਿੱਚ ਮਿਲਿਆ ਅਤੇ ਉਸ ਤੋਂ ਬਾਅਦ ਅਗਰ ਮੈਂ ਪੈਕਿੰਗ ਦੀ ਗੱਲ ਕਰਾਂ ਤਾਂ ਪੈਕਿੰਗ ਬਿਲਕੁਲ ਵਧੀਆ ਨਹੀਂ ਸੀ ਬਿਲਕੁਲ ਪਤਲੇ ਜਿਹੇ ਗੱਤੇ ਦੇ ਵਿੱਚ ਤੁਸੀਂ ਪਾ ਕੇ ਦਿੱਤੇ ਹੋਏ ਸੀ ਉਸ ਦੇ ਵਿੱਚ ਸਮਾਨ ਵੀ ਬਿਲਕੁਲ ਘੱਟ ਸੀਗਾ ਬਿਲਕੁਲ ਪੂਰਾ ਨਹੀਂ ਸੀ ਬਰੱਸ਼ਿਸ ਮੈਂ ਫਿਫਟੀ ਕਿਹਾ ਸੀ ਅਤੇ ਤੁਸੀਂ ਸਿਰਫ ਟਵੈਂਟੀ ਦਿੱਤੇ ਆ ਤਿੰਨ ਫਾਊਂਡੇਸ਼ਨ ਕਿਹਾ ਸੀ ਅਤੇ ਫਾਊਂਡੇਸ਼ਨ ਸਿਰਫ ਇੱਕ ਸੀ ਚਾਰ ਬਿਊਟੀ ਬਲੈਂਡਰ ਕਿਹਾ ਸੀ ਉਹ ਦੇ ਵਿੱਚ ਸਿਰਫ ਦੋ ਬਿਊਟੀ ਬਲੈਂਡਰ ਸੀ ਪ੍ਰਾਈਮਰ ਔਰ ਸੈਟਿੰਗ ਸਪਰੇ ਸੀ ਜੋ ਉਹ ਦੀ ਮਾਤਰਾ ਬਿਲਕੁਲ ਘੱਟ ਸੀਗੀ ਜਿਹੜੇ ਬਰੱਸ਼ਿਸ਼ ਸੀਗੇ ਉਹਨਾਂ ਦੀ ਹਾਲਤ ਬਿਲਕੁਲ ਖਰਾਬ ਸੀ ਫਿਰ ਮੈਂ ਜਦੋਂ ਉਹਨੂੰ ਖੋਲ੍ਹ ਕੇ ਵੇਖਿਆ ਤਾਂ ਉਸ ਤੋਂ ਬਾਅਦ ਮੈਂ ਸ ਕੰਸੀਲਰ ਆਪਣੇ ਹੱਥ 'ਤੇ ਅਪਲਾਈ ਕਰਕੇ ਦੇਖਿਆ ਤਾਂ ਮੈਨੂੰ ਇਰੀਟੇਸ਼ਨ ਮਹਿਸੂਸ ਹੋਈ ਅਤੇ ਫਿਰ ਜਦੋਂ ਮੈਂ ਉਸਨੂੰ ਉਤਾਰਿਆ ਤਾਂ ਮੇਰੇ ਹੱਥ 'ਤੇ ਪਿੰਪਲ ਜਿਹੇ ਹੋਣੇ ਸਟਾਰਟ ਹੋ ਗਏ ਫਿਰ ਮੈਨੂੰ ਹੋਸਪਿਟਲ ਜਾਣਾ ਪਿਆ ਮੇਰਾ ਹੋਰ ਖਰਚਾ ਵੀ ਹੋਇਆ ਉਸ 'ਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਬੋਲਿਆ ਸੀਗਾ ਕਿ ਪੈਕਿੰਗ ਕਿੱਟ ਦੋਗੇ ਉਹ ਦੇ ਨਾਲ ਇੱਕ ਪਰ ਤੁਸੀਂ ਉਹ ਵੀ ਨਹੀਂ ਦਿੱਤੀ ਹੈਗੀ ਮੈਂ ਤੁਹਾਡੇ ਇਸ ਔਡਰ ਤੋਂ ਬਿਲਕੁਲ ਖੁਸ਼ ਨਹੀਂ ਹੈਗੀ ਮੈਂ ਕਦੇ ਵੀ ਤੁਹਾਡੀ ਇਸ ਵੈਬਸਾਈਡ ਤੋਂ ਕੁਛ ਵੀ ਔਡਰ ਨਹੀਂ ਕਰਾਂਗੀ ਨਾ ਹੀ ਮੈਂ ਆਪਣੇ ਫਰੈਂਡਸ ਨੂੰ ਕਦੇ ਵੀ ਸੁਜੈਸਟ ਕਰਾਂਗੀ ਕਿ ਉਹ ਤੁਹਾਡੇ ਤੋਂ ਕੁਛ ਵੀ ਔਡਰ ਕਰਨ ਇੰਨਾ ਐਕਸਪੈਂਸਿਵ ਔਡਰ ਔਡਰ ਸੀਗਾ ਜੇ ਤੁਸੀਂ ਵੇਚਣਾ ਹੀ ਹੈ ਤਾਂ ਥੋੜ੍ਹਾ ਵਧੀਆ ਤਰੀਕੇ ਨਾਲ ਦਿਓ ਨਾ ਇੰਨੇ ਇਰਰਿਸਪੋਂਸੀਬਲ ਥੋੜ੍ਹੀ ਨਾ ਹੋਣਾ ਚਾਹੀਦਾ ਮੇਰੇ ਤੁਸੀਂ ਪੈਸੇ ਵਾਪਸ ਕਰੋ ਕਿਉਂਕਿ ਤੁਸੀਂ ਬਿਲਕੁਲ ਵੀ ਵਧੀਆ ਔਡਰ ਨਹੀਂ ਦਿੱਤਾ